ਉੱਨੀ ਸੌ ਛਿਆਹਟ ਵਿੱਚ ਪੰਜਾਬ ਕਈ ਟੁਕੜਿਆਂ ਵਿੱਚ ਵੰਡਿਆ ਗਿਆ ਜਿਸ ਨਾਲ ਹਿਮਾਚਲ ਹਰਿਆਣਾ ਰਾਜਸਥਾਨ ਦਾ ਕੁਝ ਹਿੱਸਾ ਪੰਜਾਬ ਨਾਲੋਂ ਅਲੱਗ ਕਰ ਦਿੱਤਾ ਗਿਆ ਜਿਸ ਨਾਲ ਸਿਮਲਾ ਅਜਮੇਰ ਦਿੱਲੀ ਵਰਗੇ ਵਧੀਆ ਇਲਾਕੇ ਪੰਜਾਬ ਦੇ ਹੱਥੋਂ ਖੋਹ ਲਏ ਗਏ ਅਤੇ ਪੰਜਾਬ ਬਹੁਤ ਛੋਟਾ ਰਹਿ ਗਿਆ ਜਿਵੇਂ ਕਿ ਚੰਡੀਗੜ੍ਹ ਦਾ ਵੀ ਹਰਿਆਣੇ ਹਰਿਆਣੇ ਨਾਲ ਸਾਂਝਾ ਹੋਣਾ ਪੰਜਾਬ ਦਾ ਨੁਕਸਾਨ ਕਰ ਗਿਆ ਪ੍ਰਸ਼ਾਸ਼ਨੀਤਿਕ ਤੋਰ ਤੇ ਵੀ ਕਈ ਵੱਡੀਆਂ ਰਿਹਾਸਤਾਂ ਅਲੱਗ ਹੋ ਗਈਆਂ ਅਤੇ ਜਿਵੇਂ ਜਿਸ ਨਾਲ ਪੰਜਾਬ ਰਾਜਨੀਤਿਕ ਤੋਰ ਤੇ ਵੀ ਪਿੱਛੜ ਗਿਆ ਅਤੇ ਪੰਜਾਬ ਦਾ ਇੱਕ ਹਿੱਸਾ ਰਹਿ ਗਿਆ ਪੰਜਾਬ ਸਾਰੇ ਦੇਸਾਂ ਨਾਲੋਂ ਛੋਟਾ ਰਹਿ ਗਿਆ ਅਤੇ ਪੰਜਾਬ